ਨੌਂ ਅਕਤੂਬਰ ਦੋ ਜ਼ੀਰੋ ਜ਼ੀਰੋ ਦੋ ਸੱਤ ਦਸੰਬਰ ਦੋ ਜ਼ੀਰੋ ਜ਼ੀਰੋ ਅੱਠ ਇੱਕ ਸੱਤ ਮਈ ਦੋ ਜ਼ੀਰੋ ਜ਼ੀਰੋ ਚਾਰ ਚਾਰ ਜਨਵਰੀ ਦੋ ਜ਼ੀਰੋ ਜ਼ੀਰੋ ਸੱਤ ਇੱਕ ਜ਼ੀਰੋ ਜੂਨ ਦੋ ਜ਼ੀਰੋ ਜ਼ੀਰੋ ਇੱਕ